ਮੇਰੇ ਵੱਲੋਂ ਪੜ੍ਹੀ ਗਈ ਪਹਿਲੀ ਅਤੇ ਆਖਰੀ ਕਿਤਾਬ ਰਮਾਇਣ ਹੈ ਰਮਾਇਣ ਸੀ ਰਮਾਇਣ ਹੀ ਪੜ੍ਹਦਾ ਰਿਹਾ ਹਾਂ ਅਤੇ ਹੁਣ ਵੀ ਪੜ੍ਹ ਰਿਹਾ ਹਾਂ ਅਤੇ ਰਮਾਇਣ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਰਮਾਇਣ ਜਿਹੜੀ ਜੋ ਤੁਲਸੀਦਾਸ ਜੀ ਨੇ ਰਾਮਚਰਿਤ ਮਾਨਸ ਲਿਖੀ ਹੈ ਇਸਨੇ ਮੈਨੂੰ ਬਹੁਤ ਪ੍ਰਭਾਵ ਕਰੀ ਇਸ ਵਿੱਚ ਹਰ ਇੱਕ ਦਾ ਚਰਿੱਤਰ ਆਪਣੇ ਆਪਣੇ ਬੜੇ ਸ਼ਿਖਰ 'ਤੇ ਭਾਵੇਂ ਉਹ ਰਾਮ ਜੀ ਹੋਣ ਭਰਤ ਜੀ ਹੋਣ ਲਕਸ਼ਮਣ ਜੀ ਹੋਣ ਸ਼ਤਰੂਘਨ ਜੀ ਹੋਣ ਹਰ ਇੱਕ ਦਾ ਚਰਿੱਤ ਮਾਤਾ ਸੀਤਾ ਹੈ ਦਸ਼ਰਥ ਜੀ ਦੇ ਸਭ ਦਾ ਚਰਿੱਤਰ ਬੜਾ ਬੜਾ ਚਰਿੱਤਰ ਬੜਾ ਮੈਨੂੰ ਪ੍ਰਭਾਵ ਕਰਦਾ ਹੈ ਇਸ ਵਿੱਚ ਸ਼ਬਰੀ ਦਾ ਚਰਿੱਤਰ ਹਰ ਇੱਕ ਪਾਤਰ ਦਾ ਆਪਣਾ ਆਪਣਾ ਚਰਿੱਤਰ ਹੈ ਜਿਸ ਤਰ੍ਹਾਂ ਸ਼ਬਰੀ ਦਾ ਚਰਿੱਤਰ ਭਗਵਾਨ ਰਾਮ ਜੀ ਨੇ ਸ਼ਬਰੀ ਜੀ ਨੂੰ ਨੌ ਤਰ੍ਹਾਂ ਦੀ ਭਗਤੀ ਦੱਸੀ ਹੈ ਇਹਦੇ ਵਿੱਚ ਗ੍ਰੰਥ ਵਿੱਚ ਪ੍ਰਥਮ ਭਗਤਿ ਸੰਤਨ ਕਰ ਸੰਗਾ ਦੂਸਰ ਰਤ ਮਮ ਕਥਾ ਪ੍ਰਸੰਗਾਂ ਪਤਾ ਕੀ ਇਹਦੇ ਵਿੱਚ ਮੈਂ ਦੋ ਲਾਇਨਾਂ ਤੁਹਾਨੂੰ ਦੱਸ ਦਿੱਤੀਆਂ ਕਿ ਪੰਜਾਹ ਸੰਤੋ ਕਾ ਸੰਗ ਕਰ ਲਓ ਉਹ ਵੀ ਭਗਤੀ ਆ ਜੇ ਕਿਸੇ ਦੇ ਰਾਮ ਨਾਮ ਦਾ ਨਾਮ ਜਪ ਲਿਆ ਉਹ ਵੀ ਭਗਤੀ ਹੈ ਇਸੇ ਤਰ੍ਹਾਂ ਹੀ ਇਹਦੇ ਵਿੱਚ ਸੱਤਵੀਂ ਭਗਤੀ ਆਤਮੀ ਹੈ ਸਾਤਵਾਂ ਜਥਾ ਲਾਭ ਸੰਤੋਸ਼ਾਂ ਸਪਨੇ ਮੇ ਨਹੀਂ ਦੇਖੀ ਪਰ ਦੋਸ਼ਾ ਕਿ ਸੱਤਵੀਂ ਭਗਤੀ ਹੈ ਕਿ ਤੁਸੀਂ ਸੰਤਾਂ ਦਾ ਸੰਗ ਕਰੋ ਜੋ ਤੁਹਾਨੂੰ ਜੋ ਵੀ ਤੁਹਾਨੂੰ ਮਿਲ ਗਿਆ ਉਹਦੇ 'ਚ ਸੰਤੁਸ਼ਟ ਰਹੋ ਸੱਤਵੀਂ ਭਗਤੀ ਵਿੱਚ ਅਤੇ ਸਪਨੇ ਵਿੱਚ ਵੀ ਕਿਸੇ ਦੂਸਰੇ ਦਾ ਕਿਸੇ ਪਰਾਏ ਦਾ ਦੋਸ਼ ਨਾ ਦੇਖੋ ਇਹ ਚੀਜ਼ਾਂ ਤਾਂ ਹੋਰ ਵੀ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਕਿ ਵਾਕਏ ਸਾਨੂੰ ਕਿਸੇ ਦਾ ਦੋਸ਼ ਦੇਖਣਾ ਹੀ ਨਹੀਂ ਚਾਹੀਦਾ ਅਗਰ ਉਹ ਗਲਤੀ ਕਰਦਾ ਉਹਨੂੰ ਮਾਫ਼ ਕਰ ਦੇਣਾ ਚਾਹੀਦਾ ਮਾਫ਼ੀ 'ਚ ਬੜੀ ਸ਼ਕਤੀ ਹੈ ਅਤੇ ਇਸ ਕਿਤਾਬ ਨੇ ਏ ਹਰ ਇੱਕ ਇਸ ਤਰ੍ਹਾਂ ਇਹ ਕਿਤਾਬ ਹਰ ਇੱਕ ਜੀਵ ਨੂੰ ਅਗਰ ਉਹ ਪੜ੍ਹੇਗਾ ਤਾਂ ਉਹਦੀ ਲਾਈਫ ਨੂੰ ਬੜੁ ਸੂਖਮ ਬਣਾ ਦੇਵੇਗੀ ਬੜੀ ਅੱਛਾ ਬਣਾ ਦੇਵੇਗੀ ਅਤੇ ਪਤਾ ਲੱਗਦਾ ਕਿ ਮੈਂ ਹਰ ਇੱਕ ਰਿਸ਼ਤਾ ਕਿਸ ਤਰਾਂ ਨਿਭਾਉਣਾ ਹੈ ਹਰ ਇੱਕ ਆਦਮੀ ਨੂੰ ਇਹ ਕਿਤਾਬ ਇਹ ਰਾਮਚਰਿਤ ਮਾਨਸ ਜ਼ਰੂਰ ਪੜ੍ਹਨੀ ਚਾਹੀਦੀ ਹੈ ਮੇਹਰਬਾਨੀ